ਮੈਂ ਤਾਂ ਫਸਲ ਦੇ ਹਿਸਾਬ 'ਤੇ ਹੀ ਫਸਲ ਉਗਾਉਂਦੇ ਹਨ ਜਿਵੇਂ ਕਿ ਅਬ ਝੋਨੇ ਦੀ ਫਸਲ ਦਾ ਮੌਸਮ ਹਨ ਅਤੇ ਝੋਨੇ ਜੂਨ ਮਹੀਨੇ ਮੇ ਲਗਦਾ ਹਨ ਅਤੇ ਅਤੇ ਨਵੰਬਰ ਦਸੰਬਰ ਵਿੱਚ ਗਡਾਈ ਹੋ ਜਾਂਦੀ ਹਨ ਝੋਨੇ ਦੀ ਫਸਲ ਲਈ ਪਾਣੀ ਦੀ ਵਰਤੋਂ ਸਭ ਤੋਂ ਜ਼ਿਆਦਾ ਹੁੰਦੀ ਹਨ ਜੇ ਪਾਣੀ ਹੀ ਨਹੀਂ ਹੋਵੇ ਤਾਂ ਝੋਨੇ ਦੀ ਫਸਲ ਨਹੀਂ ਹੁੰਦੀ ਹਨ ਅਤੇ ਜੇ ਹੁ ਕਣਕ ਵੀ ਨਵੰਬਰ ਜਾਂ ਅਕਤੂਬਰ ਮਹੀਨੇ ਵਿੱਚ ਹੀ ਬੀਜੀ ਜਾਂਦੀ ਹਨ ਅਤੇ ਕਣਕ ਦੀ ਕਣਕ ਦੀ ਵਰਤੋਂ ਲਈ ਵੀ ਹਮੇ ਬਹੁਤ ਸਾਰੀਆਂ ਚੀਜ਼ਾਂ ਦਾ ਚੀਜ਼ਾਂ ਦਾ ਇਸਤੇਮਾਲ ਕਰਨਾ ਪੈਂਦਾ ਹਨ ਜਿਵੇਂ ਕਿ ਕਣਕ ਸਰਦੀਆਂ ਦੇ ਮੌਸਮ ਵਿੱਚ ਹੀ ਹੁੰਦੀ ਹਨ ਅਤੇ ਕਟਾਈ ਅਪ੍ਰੈਲ ਮਹੀਨੇ ਵਿੱਚ ਹੁੰਦੀ ਹਨ ਔਰ ਮੱਕੇ ਦੀ ਫਸਲ ਵੀ ਜੂਨ ਮਹੀਨੇ ਵਿੱਚ ਬੀਜੀ ਜਾਂਦੀ ਹਨ ਅਤੇ ਇਸ ਨੂੰ ਇਸ ਨੂੰ ਨਵ ਇਸ ਨੂੰ ਸਿਤੰਬਰ ਮਹੀਨੇ ਵਿੱਚ ਕਟਾਈ ਜਾਂਦੀ ਹਨ ਬਹੁਤ ਔਰ ਬਹੁਤ ਸਾਰੀ ਸਬਜ਼ੀਆਂ ਹਨ ਜਿਵੇਂ ਪਿਆਜ ਜਨਵਰੀ ਮੇਂ ਲਗਾਏ ਜਾਂਦੇ ਹਨ ਅਤੇ ਉਸ ਨੂੰ ਮਾਰਚ ਮਹੀਨੇ ਮਾ ਪੱਟਿਆ ਜਾਂਦਾ ਹਨ ਔਰ ਸਾਰੀ ਬਹੁਤ ਛੋਟੀ ਛੋਟੀ ਸਬਜ਼ੀਆਂ ਹਨ ਜਿਵੇਂ ਕਿ ਗੋਭੀ ਵਗੈਰਾ ਮੌਸਮ ਕੇ ਹਿਸਾਬ ਮੌਸਮ ਦੇ ਹਿਸਾਬ ਨਾਲ ਉਗਾਈ ਜਾਂਦੀ ਹਨ ਬਹੁਤ ਸਾਰੀਆਂ ਛੋਟੀ ਛੋਟੀ ਸਬਜ਼ੀਆਂ ਹਨ ਮੂਲੀ ਗਾਜਰ ਆਦਿ ਪਾਲਕ ਸਰਦੀਆਂ ਦੇ ਮੌਸਮ ਵਿੱਚ ਹੀ ਉਗਾਈ ਜਾਂਦੀ ਹਨ